ਹੈਲੋ ਹਾਂਜੀ ਸੰਦੀਪ ਕੌਰ ਬੋਲ ਰਹੇ ਹੋ ਜਲ ਸਿੰਚਾਈ ਵਿਭਾਗ ਤੋਂ ਠੀਕ ਹੈ ਮੈਮ ਅਸੀਂ ਮੈਂ ਜਸਪ੍ਰੀਤ ਕੌਰ ਅਜੀਤ ਰਿਪੋਰਟਰ ਬੋਲ ਰਹੀ ਹਾਂ ਅਜੀਤ ਤੋਂ ਹਾਂਜੀ ਮੈਨੂੰ ਥੋੜ੍ਹੀ ਜਿਹੀ ਇਨਫੋਰਮੇਸ਼ਨ ਚਾਹੀਦੀ ਸੀਗੀ ਜਲ ਸਿੰਚਾਈ ਵਿਭਾਗ ਰਿਲੇਟਡ ਵੀ ਜੋ ਦਰਿਆ ਵੱਗ ਰਹੇ ਹਨ ਜਾਂ ਪਾਣੀ ਆ ਜੋ ਉਹਨਾਂ ਦੇ ਰੂਟ ਕਿੱਧਰ ਨੂੰ ਜਾਂਦੇ ਹਨ ਮਤਲਬ ਸਾਨੂੰ ਇੱਕ ਕੋਲਮ ਚਾਹੀਦਾ ਸੀ ਜਾਂ ਆਪਣੀ ਅਖਬਾਰ ਦੇ ਵਿੱਚ ਅਖਬਾਰ ਦੇ ਵਿੱਚ ਆ ਖਬਰ ਦੇਣ ਲਈ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਠੀਕ ਹੈ ਜੀ

ਹਾਂਜੀ ਹਾਂਜੀ ਠੀਕ ਹੈ ਬਾਕੀ ਹੋਰ ਮਤਲਬ ਜੇਕਰ ਜਲ ਸਿੰਚਾਈ ਵਿੱਚ ਮਤਲਬ ਅਸੀਂ ਕਿਸੇ ਨੂੰ ਕੋਈ ਇਨਫੋਰਮੇਸ਼ਨ ਦੇਣੀ ਹੈਗੀ ਆ ਵੀ ਪਾਣੀ ਨੂੰ ਕਿਵੇਂ ਸਾਫ ਰੱਖਿਆ ਜਾਵੇ ਜਾਂ ਪਾਣੀ ਨੂੰ ਵੇਸਟ ਨਾ ਕੀਤਾ ਜਾਵੇ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਲੋਕ ਇਸ ਗੱਲ ਨੂੰ ਸਮਝ ਨਹੀਂ ਰਹੇ ਲੋਕ ਇਸ ਗੱਲ ਨੂੰ ਸਮਝ ਨਹੀਂ ਰਹੇ ਵੀ ਪਾਣੀ ਇੱਥੇ ਬਹੁਤ ਜ਼ਿਆਦਾ ਜ਼ਰੂਰੀ ਹੈ ਪਰ ਇਸ ਲਈ ਅਸੀਂ ਇੱਕ ਰਿਪੋਰਟ ਬਣਾ ਰਹੇ ਹਾਂ ਮੀਡੀਆ ਦੇ ਥਰੂ ਤਾਂ ਕਿ ਲੋਕਾਂ ਨੂੰ ਪਤਾ ਲੱਗ ਸਕੇ ਵੀ ਪਾਣੀ ਬਹੁਤ ਜ਼ਰੂਰੀ ਹੈ ਇਸਨੂੰ ਜ਼ਿਆਦਾ ਵੇਸਟ ਨਹੀਂ ਕਰਨਾ ਚਾਹੀਦਾ ਹਾਂਜੀ ਇਸ ਲਈ ਤੁਹਾਡੇ ਤੋਂ ਅਸੀਂ ਸੁਝਾਅ ਲੈ ਰਹੇ ਸੀ ਵੀ ਕਿ ਅਸੀਂ ਲੋਕਾਂ ਨੂੰ ਦੱਸੀਏ ਅਖਬਾਰਾਂ ਵਿੱਚ ਖਬਰ ਛਪਾਈਏ ਅਤੇ ਮੀਡੀਏ ਦੇ ਥਰੂ ਸਾਰੀ ਇਨਫੋਰਮੇਸ਼ਨ ਦੇ ਸਕੀਏ

ਹਾਂਜੀ ਹਾਂਜੀ ਠੀਕ ਹੈ ਓਕੇ ਓਕੇ ਥੈਂਕ